ਟ੍ਰੈਡਮਿੱਲ ਜਿੰਮਾਂ ਵਿਚ ਹੁੰਦੀ ਆ ਕਿਉਂਕਿ ਜਿੰਮ ਮੈਂ ਜਾਂਦਾ ਨਹੀਂ ਗਾ ਮੈਨੂੰ ਪਾਰਕ ਕ ਕਰਨਾ ਜ਼ਮੀਨ 'ਤੇ ਤੁਰਨਾ ਨੰਗੇ ਪੈਰੀ ਬਹੁਤ ਚੰਗਾ ਲੱਗਦਾ ਕਿਉਂਕਿ ਜਿਹੋ ਜਿਹੀ ਜ਼ਮੀਨ 'ਤੇ ਤੁਰ ਲਿਆ ਉਹਦੇ ਨਾਲ ਦੀ ਜਿੰਮ ਵੀ ਰੀਸ ਨਹੀਂ ਕਰ ਸਕਦੀ ਇਸ ਕਰਕੇ ਮੈਂ ਜਾਂਦਾ ਹਾਂ ਭੱਜਦਾ ਹਾਂ ਦੌੜਦਾ ਹਾਂ ਆਪਦਾ ਸੈਰ ਕਰਦਾ ਹਾਂ ਇਸ ਤੋਂ ਇਲਾਵਾ ਕਿਹੜੀ ਜਿੰਮ ਹੋਵੇਗੀ ਜਿਹੜਾ ਵਾ ਆਪਦੇ ਹੱਥੀਂ ਪੈਰੀ ਕਰਨਾ ਸਾਰਾ ਕੁਛ ਕਰਨਾ ਕਿਉਂਕਿ ਮੈਨੂੰ ਬਹੁਤ ਚੰਗਾ ਲੱਗਦਾ ਭੱਜਣਾ ਦੌੜਨਾ ਆਪਦੀ ਸਿਹਤ ਦਾ ਖਿਆਲ ਰੱਖਣਾ ਚੰਗੀ ਤਰ੍ਹਾਂ ਆਪਦੇ ਅੰਦਰ